ਰੋਜ਼ਾਨਾ ਦੀ ਕਸਰਤ ਵਿੱਚ ਮੈਂ ਆਪਣੇ ਸਰੀਰ ਵਿੱਚ ਤਾਕਤ ਅਤੇ ਲਚਕ ਲੈ ਕੇ ਆਉਣ ਲਈ ਪੁਲਪਸ ਦੀ ਵਰਤੋਂ ਕਰਦਾ ਹਾਂ ਮੈਂ ਰੱਸੀ ਰਾਹੀਂ ਦਰੱਖਤ 'ਤੇ ਚੜਦੀ ਐਕਸਰਸਾਈਜ਼ ਵੀ ਕਰਦਾ ਹਾਂ ਜਿਸ ਨਾਲ ਮੇਰੇ ਸਰੀਰ ਵਿੱਚ ਲਚਕਤਾ ਵੀ ਆਉਂਦੀ ਹੈ ਅਤੇ ਮੇਰੀ ਤਾਕਤ ਵਿੱਚ ਵੀ ਵਾਧਾ ਹੁੰਦਾ ਹੈ ਤੁਸੀਂ ਵੀ ਆਪਣੇ ਸਰੀਰ ਨੂੰ ਲਚਕਤਾ ਲਿਆਉਣ ਲਈ ਭੰਗੜਾ ਐਰੋਬਿਕਸ ਦੀ ਵਰਤੋਂ ਵੀ ਕਰ ਸਕਦੇ ਹੋ ਕਿਉਂਕਿ ਭੰਗੜਾ ਐਰੋਬਿਕਸ ਨਾਲ ਤੁਹਾਡਾ ਸਰੀਰ ਬੜਾ ਲਚਕਦਾਰ ਬਣਦਾ ਹੈ ਇਸ ਤੋਂ ਬਿਨਾਂ ਰੱਸੀ ਟੱਪਣੇ ਦੇ ਨਾਲ ਵੀ ਤੁਹਾਡੀਆਂ ਜੋ ਮਾਸਪੇਸ਼ੀਆਂ ਨੇ ਮਜ਼ਬੂਤ ਹੁੰਦੀਆਂ ਹਨ ਚੰਗਾ ਭੋਜਨ ਚੰਗੀ ਕਸਰਤ ਕਰੋ ਇਸ ਨਾਲ ਤੁਹਾਡੀ ਜੋ ਖਿੱਚਣ ਦੀ ਰੂਟੀਨ ਹੈ ਅਤੇ ਲਚਕਤਾ